ਬੱਚਿਆਂ ਦੇ ਬਿਹਤਰ ਵਿਕਾਸ ਲਈ ਖੇਤਰੀ ਭਾਸ਼ਾਵਾਂ ਅਤੇ ਵਿਦਿਅਕ ਸਮੱਗਰੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਦਾ ਹੋਰ ਜ਼ਿਆਦਾ ਵਿਕਾਸ ਹੋ ਸਕੇ ਅੱਜ ਕੱਲ੍ਹ ਬੱਚੇ ਟੀ ਵੀ ਅਤੇ ਆਨਲਾਈਨ ਚੀਜ਼ਾਂ ਦੀ ਹੀ ਵਧੇਰੇ ਵਰਤੋਂ ਕਰਦੇ ਹਨ ਸਭ ਤੋਂ ਜ਼ਿਆਦਾ ਚੀਜ਼ਾਂ ਸਾਨੂੰ ਆਨਲਾਈਨ ਜਾਂ ਟੀ ਵੀ ਵਿੱਚ ਵੀ ਦਿਖਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਹਨਾਂ ਨੂੰ ਦੇਖ ਕੇ ਬੱਚੇ ਸਿੱਖ ਜਾਣ ਆਪਣੇ ਹੀ ਹਿਸਾਬ ਨਾਲ ਕਿ ਉਹਨਾਂ ਨੂੰ ਜਿਹੜੀ ਚੀਜ਼ ਉਹਨਾਂ ਵਾਸਤੇ ਸਹੀ ਹੋਵੇ ਬਹੁਤ ਸਾਰੇ ਨਾਵਲ ਬਣਾਉਣ ਦੀ ਵੀ ਜ਼ਰੂਰਤ ਹੈ ਜਿਨ੍ਹਾਂ ਨੂੰ ਪੜ੍ਹ ਕੇ ਬੱਚੇ ਹੋਰ ਜ਼ਿਆਦਾ ਵਿਕਾਸ ਕਰ ਸਕਣ ਅਤੇ ਬਹੁਤ ਚੀਜ਼ਾਂ ਸਿੱਖ ਸਕਣ ਵਧੇਰੇ ਚੀਜ਼ਾਂ ਸਿੱਖਣ ਦੇ ਬਾਅਦ ਹੀ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਹੋ ਸਕਦਾ ਹੈ ਸਾਨੂੰ ਬਹੁਤ ਸਾਰੀਆਂ ਬੁੱਕਸ ਨਾਵਲਾਂ ਅਤੇ ਆਨਲਾਈਨ ਮੋਬਾਈਲਾਂ ਜਾਂ ਟੀ ਵੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੀ ਲਿਆਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਕਰਕੇ ਬੱਚੇ ਉਹਨਾਂ ਚੀਜ਼ਾਂ ਨੂੰ ਹੀ ਦੇਖਣ ਜਿਨ੍ਹਾਂ ਨਾਲ ਉਹਨਾਂ ਦਾ ਵਿਕਾਸ ਹੋ ਸਕੇ